ਸਾਡੇ ਪਿੰਡ ਵਿੱਚ ਇੱਕ ਵਿਅਕਤੀ ਗੁਰਮੀਤ ਜਿਸ ਦਾ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੈ ਕਿਉਂਕਿ ਘਰ ਰਹਿਣ ਕਰਕੇ ਅਤੇ ਖਾਣ ਪੀਣ 'ਤੇ ਪਰਹੇਜ਼ ਨਾ ਕਰਨ ਕਰਕੇ ਉਸ ਦਾ ਭਾਰ ਵੱਧ ਗਿਆ ਹੈ ਜਿਸ ਕਾਰਨ ਉਸ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਪਿੰਡ ਵਿੱਚ ਇੱਕ ਵਿਅਕਤੀ ਇੱਕ ਸਰਪੰਚ ਦੁਆਰਾ ਜਿਮ ਖੋਲੀ ਗਈ ਹੈ ਅਸੀਂ ਉਹਨਾਂ ਨੂੰ ਭਾਰ ਦਾ ਇਲਾਜ ਦੱਸਣ ਲਈ ਉੱਥੇ ਜਾਣ ਦੀ ਸਲਾਹ ਦਿੱਤੀ ਹੈ